ਪੰਝੀ ਜਨਵਰੀ ਦੋ ਹਜ਼ਾਰ ਪੰਜ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਤੇਈ ਨਵੰਬਰ ਦੋ ਹਜ਼ਾਰ ਪੰਜ ਪੰਝੀ ਮਈ ਦੋ ਹਜ਼ਾਰ ਇੱਕ ਸੱਤ ਅਪ੍ਰੈਲ ਉੱਨੀ ਸੌ ਅਠਵੰਜਾ